ਭਾਰਤ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਹਨ ਜੋ ਕਿ ਆਕਰਸ਼ਨ ਦਾ ਕਾਰਨ ਹਨ ਜਿਵੇਂ ਕਿ ਤਾਜ ਮਹਿਲ ਕੁਤਬ ਮੀਨਾਰ ਇੰਡੀਆ ਗੇਟ ਅਤੇ ਸਵਰਨ ਮੰਦਰ ਤਾਜ ਮਹਿਲ ਅਕਬਰ ਨੇ ਮੁਮਤਾਜ ਲਈ ਬਣਾਇਆ ਸੀ ਜੋ ਕਿ ਆਗਰੇ ਸ਼ਹਿਰ ਵਿੱਚ ਸਥਿਤ ਹੈ ਲੱਖਾਂ ਦੀ ਗਿਣਤੀ ਵਿੱਚ ਲੋਕ ਇਸਨੂੰ ਦੇਖਣ ਆਉਂਦੇ ਹਨ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਰਾਜਾਂ ਤੋਂ ਵੀ ਲੋਕ ਦੇਖਣ ਲਈ ਆਉਂਦੇ ਹਨ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਸਵਰਨ ਮੰਦਰ ਦੀ ਅਤੇ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਅਤੇ ਕਾਫ਼ੀ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਲੋਕ ਇੱਥੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਅਤੇ ਮੱਥਾ ਟੇਕਦੇ ਹਨ ਸਵੇਰੇ ਚਾਰ ਵਜੇ ਲੋਕ ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਹਨ ਬੱਚੇ ਅਤੇ ਬਜ਼ੁਰਗ ਇੱਥੇ ਮੱਥਾ ਟੇਕਣ ਤੋਂ ਬਾਅਦ ਪਾਠ ਕਰਦੇ ਹਨ